ਹਾਂਜੀ ਕੌਣ ਹਾਂਜੀ ਨਮਸਕਾਰ ਜੀ ਹਾਂਜੀ ਹਾਂਜੀ ਮੈਮ ਆਪਣਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਕੋਈ ਗੱਲ ਨਹੀਂ ਤੁਸੀਂ ਥੋੜ੍ਹਾ ਜਿਹਾ ਮੈਨੂੰ ਆਈਡੀਆ ਦਿਓ ਫਿਰ ਮੈਂ ਉਸ ਤਰੀਕੇ ਦੇ ਤੁਹਾਨੂੰ ਫੋਟੋਆਂ ਪਾ ਦਊਂਗੀ ਹਾਂਜੀ ਹਾਂਜੀ ਵਧੀਆ ਲੱਗੇਗਾ ਇੱਕ ਤਾਂ ਜੋ ਟਾਇਲਸ ਡਿਜਾਇਨ ਆਉਂਦੇ ਹੁੰਦੇ ਹੈ ਉਹ ਵੀ ਆਉਂਦੇ ਹੈ ਅਗਰ ਤੁਸੀਂ ਸ਼ੀਟਾਂ ਲਗਾਣੀਆਂ ਹੈ ਤਾਂ ਸ਼ੀਟਾਂ ਵੀ ਲੱਗ ਜਾਣਗੀਆਂ ਉਹ ਵੀ ਬਹੁਤ ਵਧੀਆ ਹੁੰਦੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੋ ਜਾਵੇਗਾ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜਿਵੇਂ ਦਾ ਤੁਸੀਂ ਕਹੋਂਗੇ ਓਵੇਂ ਦਾ ਹੋ ਜਾਵੇਗਾ ਜੀ ਹਾਂਜੀ ਹਾਂਜੀ ਉਹ ਬਲਿਊ ਵਾਲਾ ਲੜਕ ਲੜਕਿਆਂ ਦਾ ਤਕਰੀਬਨ ਹਾਂਜੀ ਬਲਿਊ ਵਾਲਾ ਹੀ ਹੁੰਦਾ ਉਸ ਤਰੀਕੇ ਦਾ ਹੀ ਹੋ ਜਾਵੇਗਾ ਕੋਈ ਗੱਲ ਨਹੀਂ ਹੋਰ ਦੱਸੋ ਹਾਂਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਸਭ ਹਾਂਜੀ ਹਾਂਜੀ ਮੈਮ ਦੱਸੋ ਕਦੋਂ ਆਈਏ ਕਦੋਂ ਫ੍ਰੀ ਹੋਊਂਗੇ ਤੁਸੀਂ ਹਾਂਜੀ ਮੈਮ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਕੌਲ ਕਰ ਦਿਓ ਨਾ ਮੈਂ ਉਦੋਂ ਹੀ ਹਾਂਜੀ ਹਾਂਜੀ ਮੈਨੂੰ ਸਾਰੇ ਮੈਂ ਤੁਹਾਨੂੰ ਸਾਰੇ ਡਿਜ਼ਾਇਨਾਂ ਦੀ ਫੋਟੋ ਭੇਜ ਦੂੰਗੀ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਡਿਜ਼ਾਈਨ ਚਾਹੀਦੇ ਹੈ ਮੈਂ ਤੁਹਾਨੂੰ ਪਹਿਲਾਂ ਭੇਜ ਦੂੰਗੀ ਤੁਸੀਂ ਉਨ੍ਹਾਂ ਨੂੰ ਚੁਣ ਕੇ ਅਤੇ ਫਿਰ ਮੈਨੂੰ ਦੁਬਾਰਾ ਵਾਪਿਸ ਉਹ ਭੇਜ ਦਿਆ ਜੇ ਤਾਂ ਕਿ ਫਿਰ ਮੈਂ ਉਹ ਚੀਜ਼ ਨੂੰ ਤਿਆਰ ਕਰਵਾ ਸਕਾਂ ਅਤੇ ਜਲਦੀ ਤੋਂ ਜਲਦੀ ਤੁਹਾਡੇ ਘਰ ਨੂੰ ਰੈਨੋਵੇਟ ਕਰ ਸਕੀਏ ਹਾਂਜੀ ਅਤੇ ਬਾਕੀ ਬੱਚੇ ਦੇ ਵਾਸਤੇ ਆਪਾਂ ਓਵੇਂ ਨੀਲੇ ਰੰਗ ਦੀ ਜਿਵੇਂ ਆਸਮਾਨ ਵਾਲਾ ਚਾਂਦ ਸਿਤਾਰੇ ਵਾਲਾ ਉਹ ਵੀ ਕਰ ਸਕਦੇ ਹਾਂ ਜਾਂ ਵੈਸੇ ਵੇਲਜ਼ ਵਗੈਰਾ ਵਾਲਾ ਜੋ ਮਤਲਬ ਬੱਚਿਆਂ ਨੂੰ ਅੱਜ ਕੱਲ੍ਹ ਪਸੰਦ ਕਰਦੇ ਹੈ ਬੱਚੇ ਉਹ ਕਰ ਲਵਾਂਗੇ ਤੁਹਾਡਾ ਤੁਸੀਂ ਕਹੋਂਗੇ ਟਾਇਲ ਦਾ ਡਿਜ਼ਾਇਨ ਹੈ ਤਾਂ ਜੇ ਤੁਸੀਂ ਫਲਾਵ ਫੁੱਲਾਂ ਵਾਲਾ ਡਿਜਾਇਨ ਕੋਈ ਲੈਣਾ ਤਾਂ ਜੇ ਪਲੇਨ ਲੈਣੀ ਹੈ ਉਹ ਵੀ ਹੋ ਜਾਵੇਗਾ ਜਿਸ ਤਰ੍ਹਾਂ ਦਾ ਵੀ ਤੁਸੀਂ ਕਹੋਂਗੇ ਉਹ ਕੰਮ ਹੋ ਜਾਵੇਗਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੋ ਵੀ ਹੋਇਆ ਮੈਂ ਤੁਹਾਨੂੰ ਫੋਟੋਆਂ ਪਾ ਦਊਂਗੀ ਅਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਕੌਲ ਕਰਕੇ ਅਤੇ ਦੱਸ ਦੇਣਾ ਬਾਕੀ ਤੁਹਾਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਆਵੇਗਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਇੱਕ ਵਾਰ ਸੱਦ ਕੇ ਵਾਰ ਵਾਰ ਕੰਮ ਕਰਵਾਓਂਗੇ ਸਾਡੇ ਕੋਲੋਂ ਹਾਂਜੀ ਹਾਂਜੀ ਅਤੇ ਤੁਸੀਂ ਮੈਨੂੰ ਦੱਸ ਦਿਆਜੇ ਫਿਰ ਜਦੋਂ ਆਉਣਾ ਹੋਵੇ ਉਦੋਂ ਹੀ ਹਾਂਜੀ ਠੀਕ ਠੀਕ ਹੈ ਜੀ ਠੀਕ